ਹੈਲੋ ਸਤਿ ਸ਼੍ਰੀ ਅਕਾਲ ਜੀ ਹੈਲੋ ਮੈਂ ਨਾ ਸ਼ਰਮਾ ਟੈਲੀਕੋਮ ਤੋਂ ਬੋਲ ਰਹੇ ਹੋ ਭਾਅ ਜੀ ਮੈਂ ਨਾ ਮੈਂ ਤੁਹਾਡੇ ਨਾ ਪਿਛਲੇ ਹਫ਼ਤੇ ਫੋਨ ਲੈ ਕੇ ਗਈ ਸੀ ਤੁਹਾਡੇ ਤੋਂ ਹਾਂਜੀ ਅਤੇ ਉਹਦੇ 'ਚ ਨਾ ਥੋੜ੍ਹੀ ਪ੍ਰੋਬਲਮ ਆ ਰਹੀ ਹੈ ਮੈਨੂੰ ਇੱਕ ਤਾਂ ਉਹ ਹੈਂਗ ਹੋਣ ਲੱਗ ਪਿਆ ਹਾਂਜੀ ਅਤੇ ਇੱਕ ਵਾਰ ਇੱਕ ਨਾ ਉਹਨੂੰ ਦੋ ਜਾਂ ਤਿੰਨ ਵਾਰ ਚਾਰਜ ਕਰਨਾ ਪੈਂਦਾ ਮੈਨੂੰ ਹਾਂਜੀ ਹਾਂਜੀ ਹਾਂਜੀ ਸਾਰਾ ਕੁਛ ਹੈਗਾ ਠੀਕ ਹੈ ਹਾਂਜੀ ਹੂੰ ਹੂੰ ਠੀਕ ਹੈ ਨਹੀਂ ਬੱਸ ਆਹੀ ਦੋ ਚੀਜ਼ਾਂ ਨੇ ਇੱਕ ਤਾਂ ਚਾਰਜ ਨੂੰ ਕਾਫ਼ੀ ਕਰਨਾ ਪੈਂਦਾ ਇੱਕ ਹੈਂਗ ਹੋਣ ਲੱਗ ਪੈਂਦਾ ਪੀ ਡੀ ਐਫ ਫਾਈਲ ਕਾਫ਼ੀ ਆਉਂਦੀਆਂ ਨੇ ਨਾ ਬੱਚਿਆਂ ਦੀਆਂ ਠੀਕ ਹੈ ਚੱਲੋ ਮੈਂ ਨਾ ਕੱਲ੍ਹ ਨੂੰ ਬਾਕਸ ਅਤੇ ਉਹ ਸਾਰਾ ਬਿੱਲ ਵਗੈਰਾ ਨਾਲ ਲੈ ਕੇ ਆਉਂਗੀ ਓਕੇ ਹਾਂਜੀ ਠੀਕ ਹੈ ਜੀ ਓਕੇ ਜੀ ਓਕੇ